ਤਕਨਾਲੋਜੀ ਅਤੇ ਆਨਲਾਈਨ ਡਾਂਸ ਟਟੋਰੀਅਲ ਨੇ ਸੰਗੀਤ ਅਤੇ ਡਾਂਸ ਉਦਯੋਗ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਵੱਖ ਵੱਖ ਸਥਾਨਾਂ 'ਤੇ ਬੈਠੇ ਲੋਕਾਂ ਲਈ ਪਲੇਟਫਾਰਮ ਲੱਭਣਾ ਸੌਖਾ ਹੋ ਗਿਆ ਹੈ ਲੋਕ ਆਪਣੀ ਕਲਾ ਦਾ ਵਿਸਤਾਰ ਕਰਨ ਲਈ ਇੰਟਰਨੈੱਟ ਦੇ ਜ਼ਰੀਏ ਇੰਸਟਾਗ੍ਰਾਮ 'ਤੇ ਰੀਲਜ਼ ਬਣਾ ਕੇ ਅਤੇ ਯੂਟਿਊਬ ਚੈਨਲ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਰਹੇ ਹਨ ਜਦੋਂ ਕਿ ਪੁਰਾਤਨ ਸਮੇਂ ਵਿੱਚ ਮੌਕੇ ਘੱਟ ਹੁੰਦੇ ਸਨ ਅਤੇ ਪਲੇਟਫਾਰਮ ਤੱਕ ਪਹੁੰਚਣਾ ਥੋੜ੍ਹਾ ਮੁਸ਼ਕਿਲ ਮੰਨਿਆ ਜਾਂਦਾ ਸੀ